ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਮੇਰੀ ਗੱਲ ਦੁਆਬਾ ਹੋਟਲ 'ਚ ਹੋ ਰਹੀ ਹੈ ਹਾਂਜੀ ਭਾਅ ਜੀ ਮੈਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਇੱਕ ਔਡਰ ਦਿੱਤਾ ਸੀਗਾ ਸ਼ਾਹੀ ਪਨੀਰ ਦਾ ਅਤੇ ਨਾਲ ਕੁਛ ਉਹਦੇ ਫੁਲਕੇ ਸੀ ਹਾਂਜੀ ਹਾਂਜੀ ਭਾਅ ਜੀ ਉਹ ਮੈਂ ਹੀ ਦਿੱਤਾ ਹੈਗਾ ਅਸਲ 'ਚ ਹੁਣ ਮੈਂ ਉਹ ਔਡਰ ਨਹੀਂ ਲੈ ਪਾਵਾਂਗਾ ਕਿਉਂਕਿ ਮੇਰੇ ਦੋਸਤ ਦੀ ਬਹੁਤ ਹੀ ਹਾਲਤ ਖ਼ਰਾਬ ਹੋ ਗਈ ਹੈ ਅਤੇ ਉਹ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਹੈਗਾ ਆ ਇਸ ਲਈ ਮੈਂ ਉਹ ਔਡਰ ਤੋਂ ਆਪਣੇ ਕੈਂਸਲ ਕਰ ਰਿਹਾ ਹਾਂ ਮੈਂ ਨਹੀਂ ਚਾਹੁੰਦਾ ਕਿ ਜਿਹੜੇ ਤੁਹਾਡੇ ਡਿਲੀਵਰੀ ਬੋਆਏ ਹੈਗੇ ਆ ਉਹਨਾਂ ਸਿਰ ਪੀੜ ਹੋਵੇ ਸਿਰਦਰਦੀ ਹੋਵੇ ਕਿ ਉਹ ਔਡਰ ਕੋਲ ਲਉਗੇ ਫਿਰ ਮੇਰੇ ਘਰ ਆਉਣਗੇ ਮੈਨੂੰ ਫੋਨ ਕਰੂਗੇ ਮੈਂ ਨਹੀਂ ਚਾਹੁੰਦਾ ਇਹ ਸਭ ਕੁਛ ਹੋਵੇ ਇਹਦੇ ਵਿੱਚ ਤੁਹਾਨੂੰ ਵੀ ਸਿਰ ਪੀੜ ਹੈਗੀ ਡਿਲੀਵਰੀ ਬੋਆਏ ਨੂੰ ਹੈਗੀ ਅਤੇ ਮੈਨੂੰ ਵੀ ਸਿਰ ਪੀੜ ਹੋਏਗੀ ਕਿਉਂਕਿ ਮੈਂ ਆਪਣੇ ਦੋਸਤ ਦੀ ਹਾਲਤ ਲੈ ਰਿਹਾ ਹਾਲ ਪਤਾ ਲੈ ਰਿਹਾ ਹੋਉਂਗਾ ਇਸ ਕਰਕੇ ਮੈਂ ਔਡਰ ਨੂੰ ਕੈਂਸਲ ਕਰਦਾ ਪਿਆ ਹਾਂ ਅਤੇ ਜਿਹੜੀ ਮੈਂ ਪੇਮੈਂਟ ਕੀਤੀ ਸੀਗੀ ਤੁਹਾਨੂੰ ਮੈਂ ਔਨਲਾਈਨ ਪੇਮੈਂਟ ਕਰਤੀ ਸੀ ਮੈਂ ਤੁਹਾਡੇ ਤੋਂ ਗੁਜਾਰਿਸ਼ ਕਰਦਾ ਪਿਆ ਕਿ ਉਹ ਮੈਨੂੰ ਪੇਮੈਂਟ ਰਿ ਰਿਟਰਨ ਕਰ ਦਿੱਤਾ ਜਾਵੇ ਆਪ ਜੀ ਦਾ ਧੰਨਵਾਦ